ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਬੱਚੇ ਦੀ ਨਾ ਬੱਚੇ ਦੀ ਨਾ ਡਾਂਸ ਟੀਚਰ ਬੋਲਦੀ ਸੀ ਉਹ ਨਾਂ ਥੋ ਮੈਂ ਤੁਹਾਡੇ ਨਾਲ ਤੁਸੀਂ ਫਰੀ ਹੋ ਮੈਂ ਤੁਹਾਡੇ ਨਾਲ ਗੱਲ ਕਰਨੀ ਥੋੜ੍ਹੀ ਜੀ ਉਹ ਨਾ ਮੈਂ ਐਂ ਕਹਿਣਾ ਸੀਗਾ ਵੀ ਆਪਣਾ ਨਾ ਮੈਂ ਤੁਹਾਡੇ ਘਰੇ ਆਉਂਦੀ ਆ ਨਾ ਬੱਚੇ ਨੂੰ ਓ ਬੱਚੇ ਨੂੰ ਪੜ੍ਹਾਉਣ ਵਾਸਤੇ ਅਤੇ ਆਪਾਂ ਜਦੋਂ ਮਤਲਬ ਕਲਾਸ ਲਾਉਨੇ ਉਹਨਾਂ ਦੀ ਮੈਨੂੰ ਡਿਸਟਰਬਨੈਸ ਹੁੰਦੀ ਆ ਉਹਦੇ ਬਾਰੇ ਗੱਲ ਕਰਨੀ ਸੀ ਹਾਂਜੀ ਪ੍ਰੋਬਲਮ ਆਹੀ ਆ ਜਦੋਂ ਮੈਂ ਤੁਹਾਡੇ ਘਰ ਦਾ ਜਿਹੜਾ ਹੈਗਾ ਮਾਹੌਲ ਹੈਗਾ ਉਹ ਥੋੜ੍ਹਾ ਜਿਹਾ ਸਹੀ ਨਹੀਂ ਹੈਗਾ ਮਤਲਬ ਡਿਸਟਰਬੈਂਸ ਹੁੰਦੀ ਹੈ ਮੈਨੂੰ ਥੋੜ੍ਹਾ ਵੀ ਮੈਨੂੰ ਰਿਆਜ਼ ਕਰਾਉਣ ਵਿੱਚ ਬੱਚੇ ਨੂੰ ਜਿਵੇਂ ਹੁਣ ਕੁਛ ਵੀ ਅਤੇ ਹਾਂਜੀ ਹਾਂ ਹਾਂ ਤੁਸੀਂ ਬਸ ਆਹ ਆਪਣਾ ਵੇਖੋ ਵੀ ਕਿੱਥੇ ਹੋ ਸਕਦਾ ਸਹੀ ਤੁਹਾਡੇ ਨਾ ਜਦੋਂ ਕੋਈ ਵੀ ਕੋਈ ਵੀ ਕੁਛ ਕਰਦੀ ਆ ਮਤਲਬ ਉਦੋਂ ਮਤਲਬ ਸ਼ੋਰ ਹੁੰਦਾ ਸ਼ੋਰ ਵੀ ਹੁੰਦਾ ਅਤੇ ਹੋਰ ਵੀ ਪ੍ਰੋਬਲਮ ਹੁੰਦੀਆਂ ਹੈਗੀਆਂ ਤੁਸੀਂ ਤੁਸੀਂ ਦੱਸੋ ਵੀ ਤੁਹਾਡੇ ਕਿੱਥੇ ਸਹੀ ਰਹਿ ਸਕਦਾ ਜਿਵੇਂ ਤੁਸੀਂ ਉੱਪਰ ਵੀ ਕਰ ਸਕਦੇ ਆ ਜਿਵੇਂ ਆਪਣੇ ਇਹ ਉੱਪਰ ਹੋਗੇ ਛੱਤ ਉੱਪਰ ਹਾਂਜੀ ਹਾਂ ਛੱਤ ਉੱਪਰ ਇੱਕ ਰੂਮ ਹੋਵੇ ਉਹਦੇ ਵਿੱਚ ਕਰਾ ਸਕਦੀ ਹੈ ਹਮ ਹਾਂ ਇੱਥੇ ਹੋਣੀ ਚੀਹੀਦੀ ਹਾਂਜੀ

ਜੀ ਜਿਵੇਂ ਰਿਆਜ਼ ਕਰਾਉਣਾ ਹੁੰਦਾ ਉਦੋਂ ਸਾਈਲੈਂਟ ਮਾਹੌਲ ਚਾਹੀਦਾ ਅਤੇ ਫਿਰ ਉਹ ਹੋਣਾ ਚਾਹੀਦਾ ਅਤੇ ਬਾਕੀ ਹੋਰ ਠੀਕ ਹਾਂਜੀ ਹਾਂਜੀ ਠੀਕ ਹੈ ਹਾਂਜੀ ਠੀਕ ਆ ਪਰ ਮਾਹੌਲ ਦਾ ਕਰਕੇ ਥੋੜ੍ਹਾ ਜਿਹਾ ਉਹ ਹੈਗਾ ਬਸ ਉਹ ਠੀਕ ਹੋ ਗਿਆ ਤਾਂ ਬਾਕੀ ਬੱਚਾ ਠੀਕ ਆ ਹਾਂਜੀ ਠੀਕ ਆ